ਸਤਿ ਸ਼੍ਰੀ ਅਕਾਲ ਜੀ ਕੁਝ ਘੱਟ ਜਾਣੀਆਂ ਔਫ ਦਾ ਬੀਟ ਪਾਥ ਮੰਜ਼ਿਲਾਂ ਜੋ ਕਿ ਪੰਜਾਬ ਵਿੱਚ ਦੇਖਣ ਯੋਗ ਹਨ ਜਿਵੇਂ ਕਿ ਲੋਧੀ ਫੋਰਟ ਵਰਡ ਸੈਂਚੁਰੀ ਖਟਕੜ ਕਲਾਂ ਜਿਵੇਂ ਹੁਣ ਆਪਾਂ ਖਟਕੜ ਕਲਾਂ ਦੀ ਗੱਲ ਕਰੀਏ ਇਸ ਥਾਂ ਉੱਤੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਹੋਇਆ ਸੀ ਅਤੇ ਇਹ ਥਾਂ ਬੜੀ ਹੀ ਮਸ਼ਹੂਰ ਹੈ ਜੋ ਪ ਸ਼ਹੀਦ ਭਗਤ ਸਿੰਘ ਜੀ ਪੰਜਾਬ ਦੇ ਸੂਰਮੇ ਹਨ ਜਿਨ੍ਹਾਂ ਨੇ ਸਾਨੂੰ ਦੇਸ਼ ਦੇ ਲਈ ਲੜਨਾ ਸਿਖਾਇਆ ਹੈ ਅਤੇ ਉਹ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਉਮਰ ਛੋਟੀ ਹੋਵੇ ਜਾਂ ਫਿਰ ਵੱਡੀ ਕੋਈ ਵੀ ਫ਼ਰਕ ਨਹੀਂ ਪੈਂਦਾ ਸਾਨੂੰ ਆਪਣੇ ਦੇਸ਼ ਦੇ ਲਈ ਵੱਧ ਚੜ੍ਹ ਕੇ ਲੜਾਈ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਚੰਗੇ ਕੰਮ ਕਰਨੇ ਚਾਹੀਦੇ ਹਨ ਜਿੱਦਾਂ ਕਿ ਹੁਣ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਜਗ੍ਹਾਵਾਂ ਸਥਿਤ ਹਨ ਜਿਵੇਂ ਹੁਣ ਆਪਾਂ ਵਾਹਗਾ ਬਾਰਡਰ ਦੀ ਹੀ ਗੱਲ ਕਰੀਏ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਜਿੱਥੇ ਕਿ ਰੋਜ਼ ਪਰੇਡ ਹੁੰਦੀ ਹੈ ਜਿੱਥੇ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਨੂੰ ਇੱਕ ਵਧੀਆ ਤਰ੍ਹਾਂ ਦਾ ਪ੍ਰੋਗਰਾਮ ਰਚਿਆ ਜਾਂਦਾ ਹੈ ਅਤੇ ਉਸ ਥਾਂ ਉੱਤੇ ਬੜੇ ਹੀ ਦ ਲੋਕ ਦੂਰੋਂ ਦੂਰੋਂ ਇਸ ਨੂੰ ਦੇਖਣ ਆਉਂਦੇ ਹਨ ਧੰਨਵਾਦ